ਤੂਤਾਂ ਵਾਲਾ ਖੂਹ ਉਹ ਨਾਵਲ ਉਹਨਾਂ ਨੇ ਲਿਖੇ ਹੋਏ ਹਨ ਹੋਰ ਵੀ ਹੈਗੇ ਨੇ ਨਾਵਲ ਪਰ ਪਵਿੱਤਰ ਪਾਪੀ ਮੇਰਾ ਮਨਪਸੰਦ ਨਾਵਲ ਹੈ ਇਹ ਅਸਲ ਜੀਵਨ ਦੇ ਅਧਾਰ 'ਤੇ ਹੈ ਇਹ ਅੰਮ੍ਰਿਤਸਰ ਦੀ ਹਾਲ ਗੇਟ ਦੀ ਜੀਵਨ ਘਟਨਾ 'ਤੇ ਆਧਾਰਿਤ ਹੈ ਇਸ ਨਾਵਲ 'ਤੇ ਦੀ ਵੀ ਫਿਲਮ ਵੀ ਬਣੀ ਹੋਈ ਹੈ ਜੋ ਬਹੁਤ ਸੁਪਰਹਿਟ ਹੋਈ ਔਰ ਇਹਨਾਂ ਦੇ ਜਿੰਨੇ ਵੀ ਨਾਵਲ ਹਨ ਕਿਤੇ ਕਿਤੇ ਨਾ ਕਿਤੇ ਦੀ ਘਟਨਾ ਜਾਂ ਕਹਾਣੀ ਬੀਤੀ ਹੁੰਦੀ ਹੈ ਉਸ ਦੇ ਆਧਾਰ 'ਤੇ ਹੀ ਇਹ ਨਾਵਲ ਲਿਖਦੇ ਹਨ ਅਤੇ ਇਹਨਾਂ ਦੇ ਨਾਵਲ 'ਚ ਬੰਦਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਉਹ ਸਮੇਂ 'ਚ ਪਹੁੰਚ ਜਾਂਦਾ ਹੈ ਇਸ ਕਰਕੇ ਉਹਨਾਂ ਦਾ ਲਿਖਣਾ ਮੈਨੂੰ ਬਹੁਤ ਹੀ ਪਸੰਦ ਹੈ ਔਰ ਬਹੁਤ ਹੀ ਵਧੀਆ ਲਿਖਦੇ ਹਨ